ਨਵੇਂ ਬੱਚੇ ਦੇ ਜਨਮ ਉਪਰੰਤ ਅਸੀਂ ਸਭ ਤੋਂ ਪਹਿਲਾਂ ਉਸਨੂੰ ਮੌਸਮ ਅਨੁਸਾਰ ਉਸਦੇ ਕੱਪੜੇ ਪਾਵਾਂਗੇ ਅਗਰ ਸਰ ਰੁੱਤ ਹੈ ਤਾਂ ਸਰਦ ਰੁੱਤ ਦੇ ਮੁਤਾਬਿਕ ਅਤੇ ਗਰਮ ਰੁੱਤ ਤ ਗਰਮ ਰੁੱਤ ਦੇ ਮੁਤਾਬਿਕ ਉਸਦੀ ਖੁਰਾਕ ਅਤੇ ਖਾਣ ਖਰਾਕ ਵਿੱਚ ਸਭ ਤੋਂ ਪਹਿਲਾਂ ਤਾਂ ਮਾਂ ਦਾ ਦੁੱਧ ਦਾ ਪ੍ਰਯੋਗ ਕਰਾਂਗੇ ਉਸਨੂੰ ਲਗਾਤਾਰ ਪੰਜ ਸਾਲ ਦੀ ਉਮਰ ਤੱਕ ਉਸ ਨੂੰ ਮਾਂ ਦਾ ਦੁੱਧ ਹੀ ਬੁਲਾਇਆ ਜਾਵੇ ਜੋ ਪੌਦੇ ਸੇਤ ਲਈ ਬਹੁਤ ਹੀ ਮਤਲਬ

ਉਸ ਨੂੰ ਉੱਚੀ ਜਗ੍ਹਾ ਤੇ ਨਹੀਂ ਪਾਵਾਂਗੇ ਜਿੱਥੋਂ ਵੀ ਉਹ ਡੇਗ ਨਾ ਸਕੇ ਉਸ ਤੋਂ ਬਚਾ ਦੇ ਅਸੀਂ ਉਸ ਨੂੰ ਨਰ ਚੀਜ਼ਾਂ ਚ ਪਾਵਾਂਗੇ ਇਸ ਨੂੰ ਹਮੇਸ਼ਾ ਅਸੀਂ ਗਰਦਨ ਤੋਂ ਪਕੜ ਕੇ ਚੱਕਾਂਗੇ ਚੁਕਾਂਗੇ ਇਸਨੂੰ ਅਸੀਂ ਤੇਖੀ ਨਾਲ ਲਟੀਲਾਂ ਚੀਜ਼ਾਂ ਤੋਂ ਬਚਾ ਕੇ ਰੱਖਾਂਗੇ ਤਾਂ ਜੋ ਤਾਂ ਜੋ ਤਾਂ ਜੋ ਉਸਦੀ ਚਮੜੀ ਤੇ ਹੋਰ ਭਾਵਨਾ ਪੈ ਸਕੇ ਨਾ ਪੈ ਸਕੇ ਬੱਚੇ ਨੂੰ ਕੱਪੜੇ ਵਿੱਚ ਪਲੇਟ ਖੇਲ ਜਗਹਾ ਤੇ ਲੈ ਕੇ ਜਾਵਾਂਗੇ ਹੈਂ ਬੱਚੇ ਦੇ ਪਾਲਣ ਪੋਸ਼ਣ ਮੇ ਅਸੀਂ ਡਾਕਟਰ ਦੀ ਸਲਾਹ ਅਨੁਸਾਰ ਉਸ ਵਿੱਚ ਤੇਲ ਦੀ ਬਾਰਿਸ਼ ਅਤੇ ਹੋਰ ਵਧੀਆ ਵਧੀਆ ਸਮਗਰੀ ਦਾ ਬਜੁਰਗ ਪ੍ਰਯੋਗ ਕਰਾਂਗੇ ਤਾਂ ਜੋ ਉਸਦਾ ਕਾਸ ਤੇਜ਼ੀ ਨਾਲ ਹੋ ਸਕੇ ਉਹਨਾਂ ਦੀ ਬੱਚਿਆਂ ਦੀ ਇੱਕ ਸਾਲ ਜਦੋਂ ਵਿੱਚ ਪਹੁੰਚਾਵੇ ਤਾਂ ਉਸਨੂੰ ਆ ਕੇ ਦੁੱਧ ਦੇ ਨਾਲ ਅਸੀਂ ਕੋਈ ਨਾ ਵੀ ਚੀਜ਼ਾਂ ਖਾਣ ਵਾਲੇ ਚੀਜ਼ ਸਭ ਤੋਂ ਚਾਹੀਦਾ ਪ੍ਰਯੋਗ ਨਹੀਂ ਕਰਾਂਗੇ ਅਸੀਂ ਉਸ ਨੂੰ ਨੋਰਮਲ ਨੰਬਰ ਪੁਆ ਦਿੰਦੇ ਹਾ ਜਿਵੇਂ ਕਿ ਦਲੀਆ ਦਲੀਆ ਖਿਚੜੀ

ਖੁਸ਼ੀ ਦਾ ਵੀ ਪ੍ਰਯੋਗ ਅਸੀਂ ਬਿਲਕੁਲ ਲਾਜਮੀ ਨੋਰਮਲੀ ਕਰਾਂਗੇ ਇੱਕ ਸਾਲ ਦੀ ਉਮਰ ਵਿੱਚ ਬੱਚਿਆਂ ਦੀ ਖਾਨਣ ਵਾਲੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਸੋ ਉਥੇ ਮੁਤਾਬਿਕ ਕੱਪੜੇ ਪਾਏ ਜਾਣਗੇ ਤਾਂ ਜੋ ਮੌਸਮ ਉਸਦੇ ਕੋਈ